ਜਦੋਂ ਅਸੀਂ ਗੁਟਕਾ ਸਾਹਿਬ ਤੋਂ ਪਾਠ ਕਰਦੇ ਹਾਂ ਤਾਂ ਸਾਨੂੰ ਚੰਗੀ ਤਰ੍ਹਾਂ ਹੱਥ ਧੋ ਕੇ ਅਤੇ ਸਿਰ ਢੱਕ ਕੇ ਅਤੇ ਨੀਚੇ ਦਰੀ ਵਿਛਾ ਕੇ ਪਾਠ ਕਰਨਾ ਚਾਹੀਦਾ ਹੈ